ਪੰਜਾਬੀ ਭੰਗੜਾ ਜਿਹੜਾ ਆਪਣਾ ਟਰੈਡੀਸ਼ਨਲ ਜਿਹੜਾ ਕਲਚਰ ਨੂੰ ਰਿਪ੍ਰੈਜੈਂਟ ਕਰਦਾ ਹੈ ਅਸੀਂ ਕਿੱਥੇ ਵੀ ਦੇਖੀਏ ਪੰਜਾਬ ਦੇ ਅੰਦਰ ਭੰਗੜਾ ਜਿਹੜਾ ਹੈ ਇੱਕ ਆਪਣਾ ਫ ਕਹਿ ਸਕਦੇ ਹਾਂ ਕਿ ਇੱਕ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਨਾਲ ਕਲਚਰਲ ਹੈਗਾ ਹੈ ਜਿਹੜਾ ਅਸੀਂ ਸੈਲੀਬ੍ਰੇਟ ਕਰਦੇ ਹਾਂ ਅਤੇ ਅੱਜ ਦੇ ਟਾਈਮ ਦੇ ਅੰਦਰ ਇੱਕ ਟਰੈਡੀਸ਼ਨਲ ਪੰਜਾਬੀ ਇੱਕ ਰੂਟ ਹੈ ਇੱਕ ਸਾਡੀ ਜੜ੍ਹ ਹੈ ਜਿਹੜਾ ਪੰਜਾਬੀ ਭੰਗੜਾ ਹੈ ਆਪਣਾ ਠੀਕ ਹੈ ਇਹ ਹਰ ਜਗ੍ਹਾ ਪੋਪੂਲਰ ਹੋ ਚੁੱਕਿਆ ਹੈ ਈਵਨ ਅਸੀਂ ਮਿਊਜ਼ਿਕ ਦੇ ਅੰਦਰ ਵੀ ਗੱਲ ਕਰੀਏ ਜੇ ਜੁੜ ਚੁੱਕਿਆ ਹੈ ਵੈਸੇ ਭੰਗੜਾ ਵੀ ਅਤੇ ਮੈਂ ਤਾਂ ਭੰਗੜੇ ਨੂੰ ਬਹੁਤ ਜ਼ਿਆਦਾ ਪ੍ਰਤੋਸ਼ਾਹਿਤ ਕਰਦੇ ਹਾਂ ਜਿਹੜੇ ਯੰਗ ਯੂਥ ਹੈ ਚਾਹੇ ਉਹ ਕੋਲੇਜ 'ਚ ਪੜ੍ਹ ਰਿਹਾ ਚਾਹੇ ਉਹ ਸਕੂਲ 'ਚ ਪੜ੍ਹ ਰਿਹਾ ਉਹ ਸਾਰੇ ਵੱਧ ਚੜ੍ਹ ਕੇ ਇਹਦੇ ਨਾਲ ਸੈਲੀਬ੍ਰੇਟ ਕਰਦੇ ਨੇ ਅਤੇ ਭੰਗੜਾ ਹੀ ਕਿੱਦਾਂ ਪੰਜਾਬ ਦਾ ਪਹਿਲਾਂ ਜਿਹੜਾ ਸਟਾਟਿੰਗ ਦਿਨ ਦਾ ਸ਼ੁਰੂ ਜਿਹੜਾ ਹੋਇਆ ਅਤੇ ਉਹ ਅੱਜ ਦੀ ਡੇਟ 'ਚ ਕਾਫ਼ੀ ਅੱਗੇ ਤੱਕ ਜਾ ਚੁੱਕਿਆ ਹੈ ਅਤੇ ਭੰਗ ਭੰਗੜਾ ਇੱਕ ਹਰ ਯੂਥ ਦੀ ਪਹਿਚਾਣ ਬਣ ਚੁੱਕਿਆ ਹੈ ਅਤੇ ਮੈਂ ਹਰ ਇੱਕ ਬੱਚੇ ਨੂੰ ਇੱਕ ਵੱਡੇ ਨੂੰ ਉਹਨੂੰ ਮੋਟੀਵੇਟ ਕਰਾਂਗੀ ਪਈ ਭੰਗੜੇ ਨੂੰ ਸਿੱਖੋ ਅਤੇ ਟਰਡੀਸ਼ਨਲ ਹੈਗਾ ਇਹ ਤਾਂ ਆਪਣੇ ਕਲਚਰ ਨਾਲ ਜੁੜਿਆ ਹੋਇਆ ਅਤੇ ਓਰਿਜਨਲ ਆਪਣਾ ਪੰਜਾਬ ਨੂੰ ਰਿਪ੍ਰੈਜੈਂਟ ਕਰਦਾ